ਕਈ ਸਾਲਾਂ ਤੋਂ ਫੋਟੋਗ੍ਰਾਫੀ ਇਸ ਤੱਕ ਹੱਦ ਤੱਕ ਬਦਲ ਗਈ ਹੈ ਕਿ ਪਹਿਲਾਂ ਪੁਰਾਣੇ ਜ਼ਮਾਨੇ ਦੇ ਵਿੱਚ ਜੋ ਫੋਟੋਆਂ ਹੁੰਦੀਆਂ ਸੀ ਉਹ ਕਾਲੀਆਂ ਅਤੇ ਚਿੱਟੇ ਰੰਗ ਦੀਆਂ ਹੁੰਦੀਆਂ ਸੀ ਜਿਹਨਾਂ ਨੂੰ ਕੋਈ ਬਲੈਕ ਐਂਡ ਵਾਈਟ ਕਿਹਾ ਜਾਂਦਾ ਸੀ ਪਰ ਸਮੇਂ ਅਤੇ ਟੈਕਨੋਲਜੀ ਦੀ ਮਦਦ ਦੇ ਨਾਲ ਫੋਟੋਗ੍ਰਾਫੀ ਬਿਲਕੁਲ ਹੀ ਬਦਲ ਗਈ ਹੈ ਅੱਜ ਕੱਲ੍ਹ ਰੰਗੀਨ ਫੋਟੋਆਂ ਦਾ ਜ਼ਮਾਨਾ ਹੈ ਅਤੇ ਉਸਦੇ ਵਿੱਚ ਐਡੀਟਿੰਗ ਕਰਕੇ ਉਸ ਵਿੱਚ ਬਦਲਾਅ ਕਰਕੇ ਤੁਸੀਂ ਪੰਜਾਬ ਵਿੱਚ ਬੈਠੇ ਹੋਏ ਵੀ ਕੈਨੇਡਾ ਪਹੁੰਚ ਜਾਂਦੇ ਹੋ ਕਿਉਂਕਿ ਫੋਟੋਗ੍ਰਾਫੀ ਨੂੰ ਐਡਿਟ ਕਰਕੇ ਇਸ ਤਰ੍ਹਾਂ ਦਿਖਾਇਆ ਜਾਂਦਾ ਹੈ ਕਿ ਜਿਸ ਅਸਥਾਨ ਦੇ ਸੁ ਤੁਸੀਂ ਬੈਠੇ ਓਂ ਜਾਂ ਜਿਸ ਕੋਲ ਤੁਸੀਂ ਖੜ੍ਹੇ ਓਂ ਉਸਨੂੰ ਵੀ ਬਦਲਿਆ ਜਾ ਸਕਦਾ ਹੈ ਫੋਟੋਗ੍ਰਾਫੀ ਦਾ ਜਿਹੜਾ ਕਿੱਤਾ ਹੈ ਇਸਨੇ ਬਹੁਤ ਹੀ ਜ਼ਿਆਦਾ ਤਰੱਕੀ ਕਰ ਲਈ ਹੈ ਪੁਰਾਣੇ ਕੈਮਰੇ ਅਤੇ ਨਵੇਂ ਮੋਬਾਈਲ ਕੈਮਰਿਆਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਪੁਰਾਣੇ ਕੈਮਰਿਆਂ ਦਾ ਜਿਹੜਾ ਸਾਈਜ਼ ਹੁੰਦਾ ਸੀ ਜਿਹੜਾ ਉਹਨਾਂ ਦਾ ਆਕਾਰ ਹੁੰਦਾ ਸੀ ਉਹ ਕਾਫੀ ਵੱਡਾ ਹੁੰਦਾ ਸੀ ਅਤੇ ਉਸਨੂੰ ਚੱਕਣ ਲਈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲਿਜਾਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਫੋਟੋਗ੍ਰਾਫਰਾਂ ਨੂੰ ਪਰ ਅੱਜ ਕੱਲ੍ਹ ਪੁਰਾਣੇ ਕੈਮਰੇ ਨੇ ਜਿਹੜੇ ਉਹਨਾਂ ਦੀ ਜਗ੍ਹਾ ਮੋਬਾਈਲ ਫੋਨ ਦੇ ਕੈਮਰਿਆਂ ਨੇ ਲੈ ਲਈ ਹੈ ਕਿਉਂਕਿ ਜਿਹੜੇ ਮੋਬਾਈਲ ਫੋਨ ਨੇ ਇਹਨਾਂ ਨੂੰ ਆਪਾਂ ਕਿਤੇ ਵੀ ਆਸਾਨੀ ਦੇ ਨਾਲ ਚੱਕ ਕੇ ਲੈ ਕੇ ਜਾ ਸਕਦੇ ਹਾਂ ਅਤੇ ਜਿਹੜੀ ਉਹਨਾਂ ਦੀ ਫੋਟੋ ਆ ਜੋ ਕਿ ਨਵੇਂ ਮੋਬਾਈਲ ਕੈਮਰਿਆਂ ਦੀ ਦੁਆਰਾ ਖਿੱਚੀ ਜਾਂਦੀ ਜੋ ਫੋਟੋਆਂ ਹਨ ਉਹਨਾਂ ਦੀ ਜਿਹੜੀ ਕੁਆਲਿਟੀ ਆ ਉਹ ਵੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਅਤੇ ਇਹ ਬਹੁਤ ਹੀ ਸੌਖਾ ਹੋ ਗਿਆ ਹੈ ਕਿ ਮੋਬਾਈਲ ਫੋਨ ਕੈਮਰਿਆਂ ਦੀ ਮਦਦ ਦੇ ਨਾਲ ਅਸੀਂ ਆਸਾਨੀ ਨਾਲ ਕਿਸੇ ਵੀ ਸਥਾਨ 'ਤੇ ਬਹਿ ਕੇ ਫੋਟੋ ਖਿੱਚ ਸਕਦੇ ਹਾਂ